ਸਤਿ ਸ਼੍ਰੀ ਅਕਾਲ ਜੀ ਮੇਰੇ ਪਸੰਦੀਦਾਰ ਗੀਤ ਬਾਰੇ ਅੱਜ ਮੈਂ ਤੁਹਾਨੂੰ ਚਾਹਾਂਗੀ ਮੇਰੇ ਪਸੰਦੀਦਾਰ ਗੀਤ ਪੰਜਾਬੀ ਹਨ ਕਿਉਂਕਿ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅਤੇ ਮੈਨੂੰ ਪੰਜਾਬੀ ਗਾਣੇ ਸੁਣਨੇ ਜ਼ਿਆਦਾ ਵਧੀਆ ਲੱਗਦੇ ਹਨ ਉੱਦਾਂ ਤਾਂ ਕੋਈ ਵੀ ਗੀਤ ਮਾੜਾ ਨਹੀਂ ਹੁੰਦਾ ਪਰ ਮੈਨੂੰ ਪੰਜਾਬੀ ਗੀਤ ਜ਼ਿਆਦਾ ਵਧੀਆ ਲੱਗਦੇ ਹਨ ਮੈਂ ਆਪਣੇ ਦਿਨ ਦੀ ਸ਼ੁਰੂਆਤ ਵੀ ਪੰਜਾਬੀ ਸ਼ਬਦ ਤੋਂ ਕਰਦੀ ਹਾਂ ਕਿਉਂਕਿ ਉਸਨੂੰ ਸੁਣ ਕੇ ਮੇਰਾ ਦਿਨ ਚੰਗਾ ਚੜ੍ਹਦਾ ਆ ਉਹਨਾਂ ਦੇ ਨਾਲ ਮੈਨੂੰ ਇੱਕ ਅਲੱਗ ਤਰ੍ਹਾਂ ਦੀ ਸਮਝ ਆਉਂਦੀ ਹੈ ਸਮਝ ਕੇ ਸ਼ਬਦ ਨੂੰ ਇੱਕ ਅਲੱਗ ਤਰ੍ਹਾਂ ਦਾ ਉਤਸ਼ਾਹ ਆਉਂਦਾ ਆ ਅਤੇ ਇੱਕ ਨਵੀਂ ਨਵੀਂ ਸੀਖ ਮਿਲਦੀ ਆ ਅਤੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਆਪਣੇ ਘਰ ਤੋਂ ਲੈ ਕੇ ਕਾਲਜ ਤੱਕ ਆਉਂਦੀ ਹਾਂ ਅਤੇ ਮੇਰੇ ਘਰ ਤੋਂ ਕਾਲਜ ਦਾ ਰਸਤਾ ਬਹੁਤ ਜ਼ਿਆਦਾ ਦੂਰੀ 'ਤੇ ਆ ਇੱਕ ਘੰਟੇ ਦਾ ਅਤੇ ਉਹਦੇ ਵਿੱਚ ਵੀ ਮੈਂ ਆਪਣੇ ਯੂਟਿਊਬ 'ਤੇ ਲਗਾ ਕੇ ਫੋਨ 'ਤੇ ਲਗਾ ਕੇ ਪੰਜਾਬੀ ਗੀਤ ਸੁਣਨਾ ਪਸੰਦ ਕਰਦੀ ਹਾਂ ਅਤੇ ਬੜੇ ਹੀ ਵਧੀਆ ਲੱਗਦੇ ਹਨ ਮੈਨੂੰ ਇਹ ਗੀਤ ਪੰਜਾਬੀ ਗੀਤਾਂ ਨੂੰ ਸੁਣ ਕੇ ਇੱਕ ਅਲੱਗ ਹੀ ਤਰ੍ਹਾਂ ਦਾ ਸਰੀਰ ਦੇ ਵਿੱਚ ਉਤਸ਼ਾਹ ਆਉਂਦਾ ਹੈ ਖੁਦ ਬਖੁਦ ਨੱਚਣ ਦਾ ਮਨ ਕਰਦਾ ਆ ਬੜੇ ਵਧੀਆ ਲੱਗਦੇ ਹਨ ਇਹਦੇ ਵਿੱਚ ਕੁਛ ਦੁੱਖ ਭਰੇ ਵੀ ਹੁੰਦੇ ਹਨ ਉਤਸ਼ਾਹ ਵਾਲੇ ਵੀ ਹੁੁੰਦੇ ਹਨ ਅਤੇ ਬੜੇ ਹੀ ਵਧੀਆ ਬੀਟ ਵਾਲੇ ਵੀ ਹੁੰਦੇ ਹਨ ਜਿੱਦਾਂ ਕਿ ਹੁਣ ਤੁਹਾਨੂੰ ਪੰਜਾਬੀ ਗੀਤਾਂ ਦੇ ਵਿੱਚ ਕਿੰਨੇ ਸਾਰੇ ਗੀਤ ਆ ਜਾਂਦੇ ਹਨ ਅਤੇ ਸਭ ਤੋਂ ਵਧੀਆ ਮੈਨੂੰ ਉਸ ਤਰ੍ਹਾਂ ਭੰਗੜੇ ਵਾਲੇ ਗੀਤ ਲੱਗਦੇ ਹਨ ਕਿਉਂਕਿ ਮੈਨੂੰ ਭੰਗੜਾ ਬੜਾ ਪਸੰਦ ਆ ਇਸ ਕਰਕੇ ਮੇਰੇ ਪੰਜਾਬੀ ਗੀਤ ਜ਼ਿਆਦਾ ਪਸੰਦ ਲੱਗਦੇ ਹਨ ਮੈਨੂੰ ਅਤੇ ਇਹ ਮੈਂ ਜ਼ਿਆਦਾਤਰ ਫੋਨ 'ਤੇ ਟੀ ਵੀ 'ਤੇ ਅਤੇ ਯੂਟਿਊਬ 'ਤੇ ਸੁਣਦੀ ਹਾਂ ਧੰਨਵਾਦ